ਅੱਜ ਤੱਕ ਵੈਸੇ ਤਾਂ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਮਹੱਤਵਪੂਰਨ ਫੈਸਲੇ ਲਏ ਹਨ ਬਹੁਤ ਜ਼ਿਆਦਾ ਫੈਸਲੇ ਲਏ ਹਨ ਬਤ ਪਰ ਸਾਰਿਆਂ ਨਾਲੋਂ ਮਹੱਤਵਪੂਰਨ ਫੈਸਲਾ ਇਹ ਸੀ ਕਿ ਮੈਂ ਗੱਡੀ ਲੈਣਾ ਚਾਹੁੰਦੀ ਸੀ ਅਤੇ ਮੇਰੇ ਘਰ ਦੇ ਕਹਿੰਦੇ ਸੀ ਕਿ ਤੂੰ ਔਲਟੋ ਜਾਂ ਸਵਿਫਟ ਗੱਡੀ ਲੈ ਲਾ ਬਟ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਸਕੋਰਪੀਓ ਹੀ ਦਿਵਾਉ ਅਤੇ ਇਹਦੀ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਘਰਦਿਆਂ ਦੀ ਮਿੰਨਤਾਂ ਕਰਨੀਆਂ ਪਈਆਂ ਇਸ ਚੀਜ਼ ਨੂੰ ਲੈ ਕੇ ਅਤੇ ਹੋਰ ਜਿਹੜੇ ਸਲਾਹ ਦਿੰਦੇ ਸੀ ਉਹ ਵੀ ਇਹੀ ਕਹਿੰਦੇ ਸੀ ਕਿ ਸਵਿਫਟ ਹੀ ਲਓ ਜਾਂ ਫਿਰ ਆਲਟੋ ਹੀ ਲਓ ਅਤੇ ਮੈਂ ਇਹੀ ਜ਼ਿੱਦ 'ਤੇ ਅੜੀ ਰਹੀ ਕਿ ਮੈਨੂੰ ਸਕੋਰਪੀਓ ਹੀ ਚਾਹੀਦੀ ਹੈ ਅਤੇ ਸ ਇਸ ਸਕੋਰਪੀਓ ਨੇ ਅੱਗੇ ਜਾ ਕੇ ਸਾਡਾ ਬਹੁਤ ਸਾਥ ਦਿੱਤਾ ਅਤੇ ਇਸ ਵਿੱਚ ਅਸੀਂ ਸਾਰੀ ਫੈਮਿਲੀ ਇਕੱਠੇ ਹੋ ਕੇ ਜਾਂਦੇ ਸੀ ਅਤੇ ਮਤਲਬ ਜ਼ਿਆਦਾ ਜਣੇ ਉਸ ਵਿੱਚ ਇਨਵੋਲਵ ਹੋ ਜਾਂਦੇ ਨੇ ਅਤੇ ਸਾਰੇ ਵਧੀਆ ਉਹਦੀ ਚੱਲਣ ਇੰਜਣ ਵੀ ਵਧੀਆ ਸੀ ਅਤੇ ਅੱਗੇ ਜਾ ਕੇ ਸਾਡਾ ਇਨਕਮ ਦਾ ਸਾਧਨ ਵੀ ਬਣੀ ਇਸ ਨੂੰ ਅਸੀਂ ਟੈਕਸੀ ਵਜੋਂ ਵੀ ਵਾਪਰਿਆ ਅਤੇ ਇਹ ਕਈ ਵਾਰ ਅਸੀਂ ਵਿਆਹ 'ਤੇ ਵੀ ਦਿੱਤੀ ਹੈ ਸਜਾ ਕੇ ਅਤੇ ਸਾਡੇ ਇਨਕਮ ਦਾ ਵੀ ਸਾਧਨ ਬਣੀ ਅਤੇ ਸਾਨੂੰ ਇਸ ਤੋਂ ਬਹੁਤ ਜ਼ਿਆਦਾ ਵਧੀਆ ਕਮਾਈ ਹੋਈ ਅਤੇ ਸਾਡੇ ਬਹੁਤ ਜ਼ਿਆਦਾ ਕੰਮ ਆਈ